ਸਤਿ ਸ਼੍ਰੀ ਅਕਾਲ ਭਾਅ ਜੀ ਹੋਰ ਭਾਅ ਜੀ ਸੁਣਾਓ ਕਿੱਦਾਂ ਤੁਹਾਡੀ ਫਸਲਾਂ ਕੀ ਹੋਇਆ ਭਾਅ ਜੀ ਭਾਅ ਜੀ ਹਾਲ ਮੇਰਾ ਵੀ ਇਹ ਹੀ ਹਾਲ ਆ ਮੇਰੀ ਕਿੰਨੀ ਫਸਲ ਬਰਬਾਦ ਹੋਈ ਐਤਕੀ ਆਹੋ ਭਾਅ ਜੀ ਉਹ ਜਿਹੜੀ ਬਰਫ਼ ਪਈ ਹੁਣ ਪਿੱਛੇ ਜਿਹੇ ਉਹਦੇ ਨਾਲ ਵੀ ਬੜੀ ਫਸਲ ਖ਼ਰਾਬ ਹੋਈ ਹੈ ਇਹ ਸਭ ਜਿਹੜਾ ਤਾਪਮਾਨ ਵੀ ਵਧੀ ਜਾਣ ਦੇ ਨਾ ਉਹਦੇ ਨਾਲ ਵੀ ਫਸਲਾਂ ਖ਼ਰਾਬ ਹੁੰਦੀਆਂ ਹੁਣ ਤਾਂ ਉਹ ਹੀ ਹੈ ਹੁਣ ਲੋਕਾਂ ਨੂੰ ਵੀ ਥੋੜ੍ਹਾ ਸੋਚਣਾ ਚਾਹੀਦਾ ਜਿਹੜੇ ਪਰਾਲੀ ਸਾੜਦੇ ਹੈ ਇੱਦਾਂ ਫਾਲਤੂ ਜੀ ਹਾਂਜੀ ਭਾਅ ਜੀ ਖਾਦ ਖੂਦ ਬਣਾ ਲੈਣ ਕੁਛ ਹੋਰ ਕਰ ਲੈਣ ਨਹੀਂ ਪਰ ਇਹਨਾਂ ਨੂੰ ਤਾਂ ਦੂਜੀ ਚੀਜ਼ਾਂ ਹੀ ਕਰਨੀਆਂ ਨੇ ਹਾਂਜੀ ਭਾਅ ਜੀ ਆਜੋ ਫਿਰ ਸ਼ਾਮੀ ਕਰਦੇ ਹਾਂ ਵਿਚਾਰ ਹਾਂਜੀ ਭਾਅ ਜੀ ਸਾਰੇ ਮਿਲ ਕੇ ਪਿੰਡ ਵਾਲੇ ਇਕੱਠੇ ਹੋ ਕੇ ਕਰਦੇ ਆ ਕੁਛ ਇਹਦਾ ਇਲਾਜ ਓਕੇ ਭਾਅ ਜੀ ਚੰਗਾ ਬਾਏ